ਹਾਂ ਮੈਂ ਬਚਪਨ ਤੋਂ ਹੀ ਮੈਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਹੀ ਜ਼ਿਆਦਾ ਸ਼ੌਕ ਹੈ ਮੈਂ ਕਈ ਅਜਿਹੀਆਂ ਕਿਤਾਬਾਂ ਪੜ੍ਹੀਆਂ ਹਨ ਬਹੁਤ ਸਾਰੀਆਂ ਕਿਤਾਬਾਂ ਪੜ੍ਹੀਆਂ ਹਨ ਜਿਵੇਂ ਕਿ ਸਾਹਿਤਿਕ ਵਿਗਿਆਨ ਹਾਸੇ ਚੁਟਕਲੇ ਆਦਿ ਪੰਜਾਬੀ ਕਹਾਣੀਆਂ ਅਕਬਰ ਬੀਰਬਲ ਸਟੋਰੀਸ ਟਾਈਪ ਦੀਆਂ ਬਹੁਤ ਹੀ ਜ਼ਿਆਦਾ ਜੋ ਕਿ ਕਿਤਾਬਾਂ ਲਾਈਬ੍ਰੇਰੀ ਬੁੱਕਸ ਸਾਰੀਆਂ ਪੜ੍ਹੀਆਂ ਹੋਈਆਂ ਨੇ ਮੈਨੂੰ ਇਹਨਾਂ ਵਿੱਚੋਂ ਇੱਕ ਕਿਤਾਬ ਹਾਲੇ ਵੀ ਯਾਦ ਹੈ ਜੋ ਕਿ ਮੈਨੂੰ ਬਹੁਤ ਹੀ ਵਧੀਆ ਲੱਗੀ ਅਤੇ ਉਹ ਕਿਤਾਬ ਪੜ੍ਹਨ ਨਾਲ ਮੈਨੂੰ ਬਹੁਤ ਹੀ ਜ਼ਿਆਦਾ ਹਾਸਾ ਆਇਆ ਸੀ ਉਹ ਕਿਤਾਬ ਦਾ ਨਾਮ ਸੀ ਜਿਵੇਂ ਕਿ ਸਟੋਰੀ ਸੀ ਅਕਬਰ ਬੀਰਬਲ ਮੈਨੂੰ ਹਾਲੇ ਤੱਕ ਯਾਦ ਹੈ ਕਿ ਅਕਬਰ ਬੀਰਬਲ ਕਿਵੇਂ ਬੀਰਬਲ ਅਕਬਰ ਜੋ ਕਿ ਮੁਗਲਾਂ ਦਾ ਰਾਜਾ ਸੀ ਕਿਵੇਂ ਬੀਰਬਲ ਹੱਸਦੇ ਹਸਾਉਂਦੇ ਆਸਾਨੀ ਨਾਲ ਕਿਸੇ ਵੀ ਮੁਸ਼ਕਲ ਨੂੰ ਉਸਦਾ ਹੱਲ ਲੱਭ ਦਿੰਦਾ ਸੀ ਜਦੋਂ ਵੀ ਅਕਬਰ ਨੂੰ ਕੋਈ ਮੁਸ਼ਕਲ ਆਉਂਦੀ ਸੀ ਤਾਂ ਬੀਰਬਲ ਹਾਸਿਆਂ ਚੁਟਕਲਿਆਂ ਵਿੱਚ ਪਾ ਕੇ ਜਾਂ ਕਿਸੇ ਖੇਡ ਦੇ ਤਰੀਕੇ ਨਾਲ ਮੁਸ਼ਕਲ ਨੂੰ ਹੱਲ ਕਰ ਦਿੰਦਾ ਸੀ ਜਿਸ ਨੂੰ ਦੇਖ ਕੇ ਹਾਸਾ ਵੀ ਬਹੁਤ ਆਉਂਦਾ ਸੀ ਅਤੇ ਸਿੱਖਿਆ ਵੀ ਜੋ ਕਿ ਬਹੁਤ ਹੀ ਮਿਲਦੀ ਸੀ ਜਿਵੇਂ ਕਿ ਅਕਬਰ ਬੀਰਬਲ ਦੀਆਂ ਜੋ ਕਿ ਸਟੋਰੀਜ ਹੈ ਉਹ ਟੀ ਵੀ ਵਿੱਚ ਵੀ ਲੱਗਦੀਆਂ ਹਨ ਬੱਚੇ ਉਹਨਾਂ ਨੂੰ ਦੇਖ ਕੇ ਬਹੁਤ ਖੁਸ਼ ਹੁੰਦੇ ਹਨ ਅਤੇ ਮੈਨੂੰ ਵੀ ਬਹੁਤ ਇਹ ਬੁੱਕਾਂ ਵਿੱਚੋਂ ਜੋ ਕਿ ਬਹੁਤ ਹੀ ਜ਼ਿਆਦਾ ਗਿਆਨ ਵੀ ਮਿਲਦਾ ਹੈ ਮੈਨੂੰ ਇਹ ਬੁੱਕਾਂ ਵਿੱਚੋਂ ਇਹ ਅਕਬਰ ਅਤੇ ਬੀਰਬਲ ਦੀ ਸਟੋਰੀ ਪੜ੍ਹਨ ਵਿੱਚ ਬਹੁਤ ਹੀ ਜ਼ਿਆਦਾ ਹਾਸਾ ਆਇਆ ਸੀ ਕਿ ਔਰ ਹਾਸੇ ਦੇ ਨਾਲ ਨਾਲ ਇਹਨਾਂ ਵਿੱਚੋਂ ਜੋ ਕਿ ਬਹੁਤ ਸਾਰਾ ਗਿਆਨ ਵੀ ਮਿਲਦਾ ਹੈ ਅਕਬਰ ਬੀਰਬਲ ਜੋ ਕਿ ਬੀਰਬਲ ਹੈ ਉਹ ਬਹੁਤ ਹੀ ਜ਼ਿਆਦਾ ਮਤਲਬ ਅਗਰ ਮੁਸ਼ਕਲਾਂ ਵਿੱਚ ਫਸ ਜਾਂਦਾ ਸੀ ਅਤੇ ਅ ਜੋ ਕਿ ਅਗਰ ਅਕਬਰ ਜਾਂ ਅਕਬਰ ਦੇ ਪਹਿਰੇਦਾਰ ਜਾਂ ਉੱਥੋਂ ਦੇ ਰਹਿਣ ਵਾਲੇ ਨਿਵਾਸੀ ਕਿਸੇ ਮੁਸ਼ਕਲ ਵਿੱਚ ਫਸ ਜਾਂਦੇ ਸੀ ਜਾਂ ਕੋਈ ਚਲਾਕੀ ਚਤੁਰਾਈ ਕਰਦੇ ਸਨ ਤਾਂ ਬੀਰਬਲ ਬਹੁਤ ਹੀ ਆਸਾਨੀ ਨਾਲ ਆਪਣੀ ਖੇਡ ਆਪਣੀ ਦਿਮਾਗੀ ਤੌਰ 'ਤੇ ਜੋ ਕਿ ਅਕ ਬੀਰਬਲ ਸੀ ਉਹ ਬਹੁਤ ਹੀ ਚਤੁਰ ਸੀ ਹੁੰਦਾ ਸੀ ਚਤੁਰ ਸੀ ਉਹ ਬਹੁਤ ਹੀ ਆਸਾਨੀ ਨਾਲ ਚਤੁਰਾਈ ਨਾਲ ਮੁਸ਼ਕਲਾਂ ਦਾ ਹਰ ਅਸੰਭਵ ਤੋਂ ਅਸੰਭਵ ਮੁਸ਼ਕਲ ਦਾ ਹੱਲ ਲੱਭ ਲੈਂਦਾ ਸੀ ਅਤੇ ਹੱਲ ਵੀ ਇੰਝ ਲੱਭਦਾ ਸੀ ਜਿਵੇਂ ਕਿ ਕੋਈ ਖੇਡ ਕਰਦਾ ਹੋਵੇ ਇਸ ਕਾਰਨ ਮਤਲਬ ਕਿ ਉਸਦੇ ਖੇਡ ਤੋਂ ਬਹੁਤ ਹੀ ਜ਼ਿਆਦਾ ਜੋ ਕਿ ਹਾਸਾ ਪਰਿਵਰਤਨ ਹੁੰਦਾ ਸੀ ਇਸ ਲਈ ਧੰਨਵਾਦ